ਸੋਸ਼ਲ ਮੀਡੀਆ 'ਤੇ ਪਲੇਟਫਾਰਮਾਂ ਨੂੰ ਕਲਾ ਤੇ ਸ਼ਿਲਪਕਾਰੀ ਵਿੱਚ ਸ਼ਾਮਿਲ ਹੋਣ ਲਈ ਬਹੁਤ ਮਦਦ ਕੀਤੀ ਹੈ ਜਿਵੇਂ ਕਿ ਸੋਸ਼ਲ ਮੀਡੀਆ ਤੇ ਅਗਰ ਅਸੀਂ ਮੰਨੀਏ ਤਾਂ ਵੱਖ ਵੱਖ ਚੈਨਲਾਂ ਰਾਹੀਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਦੇ ਵਿੱਚੋਂ ਨਵੇਕਣ ਕਲਾ ਦਾ ਚੈਨਲ ਜਿਸ ਤੇ ਬਹੁਤ ਸੋਹਣਾ ਅਲੱਗ ਅਲੱਗ ਤਰੀਕੇ ਨਾਲ ਨਵੇਕਣ ਕਲਾਂ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਤੇ ਛੋਟੇ ਤੋਂ ਛੋਟੇ ਕਸਬੇ ਤੋਂ ਅਲੱਗ ਅਲੱਗ ਤਰ੍ਹਾਂ ਦੇ ਸ਼ਿਲਪਕਾਰੀ ਦਿਖਾਈ ਜਾਂਦੇ ਨੇ ਤੇ ਉਹਨਾਂ ਤੋਂ ਸਾਨੂੰ ਬਹੁਤ ਹੀ ਨੌਲੇਜ ਮਿਲਦੀ ਹੈ ਚਾਹੇ ਉਹ ਕੋਈ ਭਾਂਡੇ ਬਣਾਉਣ ਸਬੰਧੀ ਹੋਵੇ ਤੇ ਚਾਹੇ ਆਰਟ ਐਂਡ ਕਰਾਫਟ ਹੋਵੇ ਧੰਨਵਾਦ